ਵੈਸੇ ਤਾਂ ਹਿੰਦੀ ਜਗਤ ਦੇ ਵਿੱਚ ਬਹੁਤ ਸਾਰੇ ਅਭਿਨੇਤਾ ਹੋਏ ਹਨ ਅਰੇ ਉਹਨਾਂ ਦੀਆਂ ਬਹੁਤ ਅੱਛਾ ਅਭਿਨੇ ਵੀ ਕਰਦੇ ਹਨ ਪਰ ਮੈਨੂੰ ਇੱਕ ਅਭਿਨੇਤਾ ਪਸੰਦ ਹੈ ਬਹੁਤ ਹੀ ਅੱਛਾ ਹੈ ਉਹਦੀ ਐਕਟਿੰਗ ਮੈਨੂੰ ਬਹੁਤ ਅੱਛੀ ਲੱਗਦੀ ਹੈ ਔਰ ਉਸ ਦਾ ਨਾਮ ਹੈਗਾ ਹੈ ਧਰਮਿੰਦਰ ਮੈਨੂੰ ਧਰਮਿੰਦਰ ਇਸ ਲਈ ਪਸੰਦ ਹੈ ਕਿਉਂਕਿ ਉਹ ਪੰਜਾਬ ਦੇ ਨਾਲ ਵੀ ਬਿਲੋਂਗ ਕਰਦਾ ਹੈ ਰਿਲੇਟਿਡ ਹੈ ਉਸ ਦੇ ਨਾਲ ਉਹਦਾ ਸੰਬੰਧ ਹੈ ਕਿਉਂਕਿ ਉਹ ਪੁਰਾਣਾ ਉਹਦਾ ਪਿਛੋਕੜ ਜੋ ਵੀ ਆ ਉਹ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਉਸਦੀ ਐਕਟਿੰਗ ਮੈਨੂੰ ਬਹੁਤ ਅੱਛੀ ਲੱਗਦੀ ਹੈ ਔਰ ਉਹਨੇ ਬਹੁਤ ਸਾਰੀਆਂ ਹੀ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ ਜਿਹੜੀਆਂ ਕਿ ਸਾਨੂੰ ਬਹੁਤ ਪਸੰਦ ਹਨ ਉਹਨਾਂ ਵਿੱਚੋਂ ਇੱਕ ਫਿਲਮ ਹੈ ਜਿਹੜੀ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਹਾਂ ਉਹ ਹੈ ਸ਼ੋਲੇ ਫਿਲਮ ਅਰ ਉਹ ਸ਼ੋਲੇ ਫਿਲਮ ਦੇ ਅੰਦਰ ਉਸਦਾ ਕਿਰਦਾਰ ਜਿਹੜਾ ਹੈ ਉਹ ਮੈਨੂੰ ਬਹੁਤ ਹੀ ਅੱਛਾ ਲੱਗਦਾ ਹੈ ਉਹ ਸ਼ੋਲੇ ਫਿਲਮ ਦਾ ਕਿਰਦਾਰ ਤਾਂ ਵੈਸੇ ਵੀ ਉਹ ਸ਼ੋਲੇ ਫਿਲਮ ਦੇ ਹਰ ਕਿਰਦਾਰ ਜਿਹੜੇ ਹਨ ਬਹੁਤ ਅੱਛੇ ਹਨ ਉਹਨਾਂ ਦੇ ਅੱਜ ਵੀ ਡਾਇਲੋਗ ਵਗੈਰਾ ਹਨ ਜੋ ਉਹਨਾਂ ਨੇ ਉਦੋਂ ਅਭਿਨੇ ਦੇ ਵਿੱਚ ਆਪਣੀ ਅਦਾਕਾਰੀ ਦੇ ਵਿੱਚ ਉਹਨਾਂ ਨੂੰ ਕੀਤਾ ਹੈ ਤਾਂ ਉਹ ਅੱਜ ਹਰ ਬੱਚੇ ਦੀ ਜ਼ੁਬਾਨ ਦੇ ਉੱਤੇ ਉਹਨਾਂ ਦੇ ਜਿਹੜੇ ਹਰ ਹੀਰੋ ਦੀ ਐਕਟਿੰਗ ਅਤੇ ਉਹਨਾਂ ਦੇ ਜਿਹੜੇ ਬੋਲੇ ਗਏ ਉਹਨਾਂ ਦੇ ਡਾਇਲੋਗ ਨੇ ਉਹ ਪਸੰਦ ਕੀਤੇ ਜਾਂਦੇ ਹਨ ਅਤੇ ਉਹਨਾਂ ਦੇ ਵਿੱਚੋਂ ਹੀ ਸ਼ੋਲੇ ਫਿਲਮ ਦੇ ਅੰਦਰ ਹੀ ਜਿਹੜਾ ਉਹਦਾ ਧਰਮਿੰਦਰ ਦਾ ਰੋਲ ਹੈ ਉਹ ਹੈਗਾ ਇੱਕ ਵੀਰੂ ਦਾ ਵੀਰੂ ਦਾ ਰੋਲ ਹੈ ਉਹ ਬਹੁਤ ਹੀ ਅੱਛਾ ਲੱਗਦਾ ਹੈ ਉਹਦੀ ਐਕਟਿੰਗ ਉਹਦੇ ਵਿੱਚ ਬਹੁਤ ਹੀ ਅੱਛੀ ਉਹਨੇ ਕੀਤੀ ਹੈ ਉਹਦੇ ਵਿੱਚ ਉਹਨੇ ਆਪਣੀ ਐਕਟਿੰਗ ਦੇ ਵਿੱਚ ਕੋਮੇਡੀਅਨ ਵੀ ਪਾਈ ਹੈ ਯਾਨੀ ਕਿ ਹਾਸੇ ਕਲਾਕਾਰ ਦੀ ਵੀ ਭੂਮਿਕਾ ਥੋੜ੍ਹੀ ਜਿਹੀ ਪਾਈ ਹੈ ਅਤੇ ਉਸਨੇ ਆਪਣੇ ਟ੍ਰੈਜਡੀ ਯਾਨੀ ਕਿ ਉਹਨੇ ਐਕਸ਼ਨ ਉਹਨੇ ਵੀ ਉਹਦੇ ਵਿੱਚ ਦਿੱਤਾ ਹੈ ਉਹ ਫਿਲਮ ਬਹੁਤ ਹੀ ਸੁੰਦਰ ਅਤੇ ਅੱਛੀ ਹੈਗੀ ਆ ਜਿਹੜੀ ਅੱਜ ਵੀ ਹਿੰਦੁਸਤਾਨ ਦੇ ਵਿੱਚ ਸ਼ੋਲੇ ਫਿਲਮ ਬਹੁਤ ਹੀ ਅੱਛੀ ਅਤੇ ਸੁਪਰ ਹਿੱਟ ਮੰਨੀ ਜਾਂਦੀ ਹਨ ਅਤੇ ਬਲੋਕਬਾਸਟਰ ਮੰਨੀ ਜਾਂਦੀ ਹੈ